ਦੌੜਨਾ ਸਾਡੀ ਜ਼ਿੰਦਗੀ ਵਿੱਚ ਸਾਰੀ ਭੱਜ ਦੌੜ ਹੀ ਹੈ ਪਰ ਦੌੜਨਾ ਸਾਡੀ ਸਿਹਤ ਲਈ ਵੀ ਬਹੁਤ ਜਿਆਦਾ ਫ਼ਾਇਦੇਮੰਦ ਹੈ ਕਿਉਂਕਿ ਜੇ ਅਸੀਂ ਤੰਦਰੁਸਤ ਹੋਵਾਂਗੇ ਤਾਂ ਜ਼ਿੰਦਗੀ ਵਿੱਚ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਵਿਦਿਆਰਥੀਆਂ ਲਈ ਖ਼ਾਸ ਕਰਕੇ ਛੋਟਿਆਂ ਬੱਚਿਆਂ ਲਈ ਜਦੋਂ ਉਹਨਾਂ ਨੇ ਵੱਧਨਾ ਹੁੰਦਾ ਤਾਂ ਉਹਨਾਂ ਲਈ ਦੌੜਨਾ ਬਹੁਤ ਜ਼ਰੂਰੀ ਹੈ ਦੌੜਨ ਨਾਲ ਉਹ ਚੁਸਤ ਫੁਰਤ ਹੁੰਦੇ ਹਨ ਕਿਉਂਕਿ ਜੇ ਸਰੀਰ ਦੀਆਂ ਮਾਸਪੇਸ਼ੀਆਂ ਚੰਗੀ ਤਰ੍ਹਾਂ ਕੰਮ ਕਰਨਗੀਆਂ ਤਾਂ ਸਾਡਾ ਦਿਮਾਗ ਵੀ ਬਹੁਤ ਵਧੀਆ ਤਰ੍ਹਾਂ ਕੰਮ ਕਰੇਗਾ ਕਈ ਖੇਤਰਾਂ ਦੇ ਵਿਦਿਆਰਥੀ ਕਈ ਸਕੂਲ ਇਹੋ ਜਿਹੇ ਹਨ ਜਿਹੜੇ ਕਿ ਬੱਚਿਆਂ ਨੂੰ ਖੇਡਾਂ ਕੁੱਦਾਂ ਵਿੱਚ ਪ੍ਰੋਤਸ਼ਾਹਿਤ ਕਰਦੇ ਹਨ ਤਾਂ ਕਿ ਉਹਨਾਂ ਦੀ ਸਿਹਤ ਅੱਛੀ ਰਹੇ ਆਪਾਂ ਨੂੰ ਪਤਾ ਹੈ ਕਿ ਇੱਕ ਜਿਹੜਾ ਖਿਡਾਰੀ ਹੁੰਦਾ ਉਹ ਹਰ ਤਰ੍ਹਾਂ ਨਾਲ ਚੰਗਾ ਇਨਸਾਨ ਬਣ ਸਕਦਾ ਚੰਗਾ ਨੇਤਾ ਬਣ ਸਕਦਾ ਹੈ ਚੰਗਾ ਅਧਿਆਪਕ ਬਣ ਸਕਦਾ ਚੰਗਾ ਗਵਾਹੀ ਕਾਰ ਬਣ ਸਕਦਾ ਇਸ ਕਰਕੇ ਸਾਨੂੰ ਸਿਹਤਮੰਦ ਰਹਿਣ ਵਾਸਤੇ ਅਤੇ ਇੱਕ ਚੰਗੇ ਭਵਿੱਖ ਦੀ ਸਿਰਜਣਾ ਕਰਨ ਵਾਸਤੇ ਦੌੜਨਾ ਬਹੁਤ ਜ਼ਰੂਰੀ ਹੈ ਛੋਟੇ ਬੱਚੇ ਜਿਹਨਾਂ ਦੇ ਵਿੱਚ ਕਹਿ ਦੇਈਏ ਅਥਾਹ ਸ਼ਕਤੀ ਹੁੰਦੀ ਹੈ ਉਹਨਾਂ ਨੂੰ ਅਗਰ ਦੌੜ ਭੱਜ ਜਾਂ ਕਿਸੇ ਕੰਮ ਦੇ ਵਿੱਚ ਲਗਾਇਆ ਜਾਵੇ ਤਾਂ ਉਹ ਬੱਚੇ ਇਸ ਦਾ ਸਹੀ ਪ੍ਰਯੋਗ ਕਰ ਸਕਦੇ ਹਨ ਕਿਉਂਕਿ ਜੇ ਬੱਚਿਆਂ ਦੀ ਅਥਾਹ ਸ਼ਕਤੀ ਨੂੰ ਕਿਸੇ ਸਹੀ ਪਾਸੇ ਨਾ ਲਗਾਇਆ ਜਾਵੇ ਤਾਂ ਸਾਡੇ ਬੱਚੇ ਗਲਤ ਪਾਸੇ ਤੁਰ ਸਕਦੇ ਨੇ ਇਸ ਕਰਕੇ ਬੱਚਿਆਂ ਨੂੰ ਖੇਡ ਕੁੱਦ ਭੱਜਣ ਭਜਾਉਣ ਵਾਲੀਆਂ ਖੇਡਾਂ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਕਿ ਉਹ ਸਿਹਤਮੰਦ ਰਹਿਣ ਉਹਨਾਂ ਦੀ ਸਰੀਰਕ ਅਤੇ ਮਾਸਪੇਸ਼ੀਆਂ ਦੀ ਕਸਰਤ ਹੋਵੇ ਉਸ ਕਸਰਤ ਦੇ ਹੋਣ ਨਾਲ ਉਹਨਾਂ ਦਾ ਦਿਮਾਗ ਵੀ ਬਹੁਤ ਅੱਛੀ ਤਰ੍ਹਾਂ ਕੰਮ ਕਰੇਗਾ